ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂਜੀ ਹੋਰ ਸੁਣਾਓ ਠੀਕ ਠਾਕ ਹੋ ਹਾਂ ਹਾਂ ਮੈਂ ਨਾ ਇਹ ਹੀ ਪੁੱਛਣਾ ਚਾਹੁੰਦਾ ਸੀ ਵੀ ਜਿੱਦਾਂ ਅੱਜ ਕੱਲ੍ਹ ਬੱਚਿਆਂ ਨੂੰ ਦਾਖਲ ਕਰਾਉਣਾ ਛੋਟੇ ਨੂੰ ਅਤੇ ਉਹ ਫਿਰ ਸਕੂਲ ਉੱਥੇ ਉਹਦੇ ਬਾਰੇ ਡਿਸਕਸ ਕਰਨਾ ਚਾਹੁੰਦੇ ਸੀ ਵੀ ਕਿੱਦਾਂ ਕਿਹੜੇ ਸਕੂਲ ਚੰਗੇ ਆ ਜਿਵੇਂ ਫਤਿਹ ਅਕੈਡਮੀ ਹੈ ਦਿੱਲੀ ਪਬਲਿਕ ਹੈ ਅਤੇ ਹੋਰ ਵੀ ਹੈ ਉਹਦੇ ਬਾਰੇ ਵਿਚਾਰ ਵਟਾਂਦਰਾ ਕਰਨਾ ਚਾਹੁੰਦੇ ਸੀ ਅੱਛਾ ਨਰਾਇਣਾ ਠੀਕ ਹੈ ਗੁੱਡ ਗੁੱਡ ਠੀਕ ਠੀਕ ਠੀਕ ਹਾਂ ਹਰਕ੍ਰਿਸ਼ਨ ਪਬਲਿਕ ਸਕੂਲ ਹਰਕ੍ਰਿਸ਼ਨ ਪਬਲਿਕ ਸਕੂਲ ਵੀ ਹੈ ਹਾਂ ਹਾਂ ਠੀਕ ਹੈ ਠੀਕ ਹੈ ਠੀਕ ਹੈ ਹਾਂ ਹਾਂ ਹਾਂ ਹਾਂ ਹਾਂ ਬਿਲਕੁਲ ਬਿਲਕੁਲ ਬਿਲਕੁਲ ਮੈਂ ਤਾਂ ਦੇਖ ਰਿਹਾ ਉਹ ਹੀ ਵੀ ਨਰਾਇਣਾ ਸਕੂਲ ਵੀ ਤਕਰੀਬਨ ਕਾਫ਼ੀ ਮਤਲਬ ਪ੍ਰਚਲਿਤ ਹਾਂ ਹਾਂ ਅੱਛਾ ਹਾਂ ਹਾਂ ਹਾਂ ਚਲੋ ਬਹੁਤ ਵਧੀਆ ਹਾਂ ਠੀਕ ਠੀਕ ਠੀਕ ਓਕੇ ਓਕੇ ਓਕੇ ਠੀਕ